ਇਕ ਆਮ ਭੰਗੜਾ ਐਰੋਬਿਕਸ ਮੁਕਾਬਲੇ ਨੂੰ ਕਈ ਵੱਖ ਵੱਖ ਦੌਰਾਂ ਵਿੱਚ ਬਣਾਇਆ ਗਿਆ ਹੈ ਜੋ ਪ੍ਰਦਰਸ਼ਨ ਦੇ ਵੱਖ ਵੱਖ ਪਹਿਲੂਆਂ ਨੂੰ ਪ੍ਰਦਰਸ਼ਿਤ ਕਰਦੇ ਹਨ ਮੁਕਾਬਲਾ ਆਮ ਤੌਰ 'ਤੇ ਸੋਲੋ ਪ੍ਰਦਰਸ਼ਨ ਦੌਰ ਨਾਲ ਸ਼ੁਰੂ ਹੁੰਦਾ ਹੈ ਜਿੱਥੇ ਵਿਅਕਤੀਗਤ ਭਾਗੀਦਾਰ ਭੰਗੜਾ ਐਰੋਬਿਕਸ ਵਿੱਚ ਆਪਣੇ ਹੁਨਰ ਰਚਨਾਤਮਕ ਅਤੇ ਤਕਨੀਕੀ ਹੁਨਰ ਦਾ ਪ੍ਰਦਰਸ਼ਨ ਕਰਦੇ ਹਨ ਇਸ ਤੋਂ ਬਹੁਤ ਸਮੂਹ ਪ੍ਰਦਰਸ਼ਨ ਦੌਰ ਹੈ ਜਿੱਥੇ ਟੀਮਾਂ ਔਰੀ ਕੋਰੀਓਗਰਾਫ ਕੀਤਿਆਂ ਰੂਟੀਨ ਕਰਦੀਆਂ ਹਨ ਜੋ ਉਹਨਾਂ ਦੇ ਤਾਲਮੇਲ ਟੀਮਵਰਕ ਅਤੇ ਉਜਾਗਰ ਨੂੰ ਊਰਜਾ ਨੂੰ ਉਜਾਗਰ ਕਰਦੀਆਂ ਹਨ ਇਸ ਦੇ ਬਾਅਦ ਅਕਸਰ ਇੱਕ ਥੀਮੈਟਿਕ ਰੂਟੀਨ ਭਾਗ ਹੁੰਦਾ ਹੈ ਜਿੱਥੇ ਪ੍ਰਦਰਸ਼ਨ ਖਾਸ ਥੀਮ ਜਾਂ ਸੰਕਲਪਾਂ 'ਤੇ ਅਧਾਰਿਤ ਹੁੰਦੇ ਹਨ ਜਿਸ ਵਿੱਚ ਭਾਗੀਦਾਰਾਂ ਨੂੰ ਥੀਮ ਦੇ ਅਨੁਸਾਰ ਐਰੋਬਿਕਸ ਅਭਿਆਸਾਂ ਦੇ ਨਾਲ ਰਚਨਾਤਮਕ ਤੌਰ 'ਤੇ ਭੰਗੜੇ ਦੇ ਕਦਮਾਂ ਨੂੰ ਮਿਲਾਉਣ ਦੀ ਲੋੜ ਹੁੰਦੀ ਹੈ ਤਕਨੀਕੀ ਰੂਟੀਨ ਦੌਰ ਐਰੋਬਿਕਸ ਅਤੇ ਭੰਗੜਾ ਤੱਤਾਂ ਦੇ ਤਕਨੀਕੀ ਐਗਜੀਕਿਊਸ਼ਨ ਦਾ ਮੁਕ ਮੂਲਾਂਕਨ ਕਰਦੇ ਹੋਏ ਅੰਦੋਲਨਾਂ ਦੀ ਸ਼ੁਰੂਆਤ ਅਤੇ ਜਟਿਲਤਾ 'ਤੇ ਜ਼ੋਰ ਦਿੰਦਾ ਹੈ ਇੱਕ ਫਰੀ ਸਟਾਈਲ ਰਾਊਂਡ ਕਲਾਕਾਰਾਂ ਨੂੰ ਭੰਗੜਾ ਐਰੋਬਿਕਸ ਫਰੇਮਵਰਕ ਦੇ ਅੰਦਰ ਉਹਨਾਂ ਦੀ ਨਿੱਜੀ ਸ਼ੈਲੀ ਅਤੇ ਨਵੀਨਤਾ ਦਾ ਪ੍ਰਦਰਸ਼ਨ ਕਰਦੇ ਹੋਏ ਸੁਧਾਰ ਕਰਨ ਦੀ ਇਜਾਜ਼ਤ ਦਿੰਦਾ ਹੈ ਮੁਕਾਬਲਾ ਜ਼ਿੰਗਜ਼ਿੰਗ ਨਾਲ ਸਮਾਪਤ ਹੁੰਦਾ ਹੈ ਜਿੱਥੇ ਅੱਜ ਕੋਰੀਓਗ੍ਰਾਫੀ ਐਗਜੀਕਿਊਸ਼ਨ ਸਿੰਕਰੋਨਾਈਜੇਸ਼ਨ ਰਚਨਾਤਮਕ ਅਤੇ ਸਮੁੱਚੀ ਪੇਸ਼ਕਾਰੀ ਦੇ ਆਧਾਰ 'ਤੇ ਪ੍ਰਦਸ਼ਨਾਂ ਦਾ ਮੁਲਾਂਕਣ ਕਰਦੇ ਹਨ ਇਸ ਤੋਂ ਇਲਾਵਾ ਸਰੋਤਿਆਂ ਦੇ ਸ਼ਮੂਲੀਅਤ ਵਾਲੇ ਹਿੱਸੇ ਜਿਵੇਂ ਕਿ ਦਰਸ਼ਕ ਵੋਟਿੰਗ ਜਾਂ ਭਾਗੀਦਾਰੀ ਨੂੰ ਘਟਨਾ ਦੇ ਇੰਟਰਐਕਟਿਵ ਪਹਿਲੂ ਨੂੰ ਵਧਾਉਣ ਲਈ ਸ਼ਾਮਿਲ ਕੀਤਾ ਜਾ ਸਕਦਾ ਹੈ